ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਨਾ ਸਿੰਪਲਪ੍ਰੀਤ ਗੱਲ ਕਰ ਰਹੀ ਹਾਂ ਮੈਨੂੰ ਤੁਹਾਡਾ ਨੰਬਰ ਨਾ ਮੇਰੀ ਫਰੈਂਡ ਤੋਂ ਮਿਲਿਆ ਉਹ ਪਿਛਲੇ ਮਹੀਨੇ ਹੀ ਸ਼ਾਇਦ ਵਿਜ਼ਿਟ ਕਰਨ ਆਈ ਸੀਗੀ ਅੰਮ੍ਰਿਤਸਰ ਅਤੇ ਮੈਨੂੰ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਸਰ ਐਕਚੁਲੀ ਨਾ ਮੈਂ ਅੰਮ੍ਰਿਤਸਰ ਵਿਜ਼ਿਟ ਕਰਨਾ ਚਾਹੁੰਦੀ ਹਾਂ ਵਾਹਗਾ ਬਾਰਡਰ ਅਤੇ ਗੋਲਡਨ ਟੈਂਪਲ ਸਰ ਵਾਹਗਾ ਬਾਰਡਰ ਅਤੇ ਗੋਲਡਨ ਟੈਂਪਲ ਜੀ ਸਰ ਸਰ ਮੈਂ ਆ ਰਹੀ ਹਾਂ ਅਪਕਮਿੰਗ ਆਹ ਪੰਜ ਅਤੇ ਛੇ ਤਾਰੀਕ ਨੂੰ ਆ ਰਹੀ ਹਾਂ ਮੈਂ ਠੀਕ ਹੈ ਸਰ ਅਤੇ ਸਰ ਮੈਨੂੰ ਥੋੜ੍ਹਾ ਜਿਹਾ ਗਾਈਡ ਕਰ ਸਕਦੇ ਹੋ ਕਿ ਮਤਲਬ ਕਿੰਨੇ ਚਾਰਜਿਸ ਆ ਜਾਂ ਕਿਵੇਂ ਤੁਹਾਡਾ ਸਰ ਹੈਗਾ ਠੀਕ ਹੈ ਸਰ ਜੀ ਜੀ ਜੀ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਠੀਕ ਹੈ ਅਤੇ ਠੀਕ ਹੈ ਸਰ ਫਿਰ ਮੈਂ ਮਤਲਬ ਆਉਣਾ ਹੈਗਾ ਉਦੋਂ ਮਤਲਬ ਪੰਜ ਛੇ ਤਰੀਕ ਨੂੰ ਮੈਂ ਵਿਜ਼ਿਟ ਕਰਨਾ ਅਤੇ ਚਾਰ ਦੀ ਈਵਨਿੰਗ ਨੂੰ ਮੈਂ ਪਹੁੰਚ ਜਾਵਾਂਗੀ ਉੱਥੇ ਠੀਕ ਹੈ ਸ਼ੋਅਰ ਸਰ ਠੀਕ ਹੈ ਸਰ ਫਿਰ ਮਤਲਬ ਠੀਕ ਜੀ ਹਾਂਜੀ ਜੀ ਸਰ ਬਿਲ